ਮੈਂ ਬੱਸ ਤੋਂ ਚੰਡੀਗੜ੍ਹ ਜਾ ਰਿਹਾ ਸੀ ਜੋ ਕਿ ਸਵਾਰੀਆਂ ਨਾਲ ਭਰੀ ਹੋਈ ਸੀ ਇਹ ਬੱਸ ਸਰਕਾਰੀ ਬੱਸ ਹੈਗੀ ਸੀ ਬੱਸ ਵਿੱਚ ਸਭ ਤੋਂ ਅੱਗੇ ਡਰਾਈਵਰ ਦੀ ਸੀਟ ਨਾਲ ਇੱਕ ਹੋਰ ਸੀਟ ਸੀ ਜੋ ਕਿ ਸਾਰੇ ਰਸਤੇ ਵਿੱਚ ਖਾਲੀ ਸੀ ਡਰਾਈਵਰ ਨੇ ਆਪਣੀ ਸੀਟ ਹੋਰਾਂ ਸੀਟਾਂ ਤੋਂ ਵੱਖਰੀ ਅਤੇ ਸੋਹਣੀ ਰੱਖੀ ਹੋਈ ਸੀ ਉਸ ਨੇ ਆਪਣੀ ਸੀਟ 'ਤੇ ਇੱਕ ਨਰਮ ਕੱਪੜਾ ਵਿਛਾਇਆ ਹੋਇਆ ਸੀ ਬੱਸ ਵਿੱਚ ਸਟੋਰੇਜ ਕੈਰੀਅਰ ਉੱਪਰ ਵੀ ਸਮਾਨ ਪਿਆ ਹੋਇਆ ਸੀ ਜੋ ਕਿ ਰਸਤੇ ਵਿੱਚ ਉਤਾਰ ਲਿਆ ਗਿਆ ਵਿੰਡੋ ਸੀਟਾਂ 'ਤੇ ਪੂਰੇ ਰਸਤੇ ਸਵਾਰੀਆਂ ਬੈਠੀਆਂ ਰਹੀਆਂ ਜੋ ਕਿ ਬਹਾਰ ਦਾ ਨਜ਼ਾਰਾ ਲੈ ਕੇ ਆਨੰਦ ਮਨਾ ਰਹੇ ਸੀ ਬੱਸ ਦਿਨ ਚੜ੍ਹਨ ਤੋਂ ਬਾਅਦ ਚੱਲੀ ਸੀ ਅਤੇ ਰਸਤੇ ਵਿੱਚ ਥੋੜ੍ਹੀ ਜਿਹੀ ਬਾਰਿਸ਼ ਪੈਣ ਕਰਕੇ ਮੌਸਮ ਵੀ ਸਾਫ ਹੋ ਗਿਆ ਸੀ ਅਤੇ ਰਸਤੇ ਵਿੱਚ ਖੇਤਾਂ ਦਾ ਦ੍ਰਿਸ਼ ਵੀ ਵਿਖਾਈ ਦੇ ਰਿਹਾ ਸੀ ਰਸਤੇ ਵਿੱਚ ਹਿਰਨ ਵੀ ਵਿਖੇ ਜੋ ਕਿ ਇੱਧਰ ਉੱਧਰ ਜਾ ਰਹੇ ਸੀ ਅਤੇ ਬੱਸ ਨੂੰ ਵੇਖ ਕੇ ਭੱਜ ਗਏ